ਅੱਜ ਕੱਲ੍ਹ ਦਾ ਮੀਡੀਆ ਹੈ ਜੋ ਉਹ ਆਮ ਜਨਤਾ ਦਾ ਨਾ ਹੋ ਕੇ ਸਰਕਾਰਾਂ ਦੇ ਹੱਥ ਦੇ ਵਿੱਚ ਜ਼ਿਆਦਾ ਹੈ ਜੋ ਸਰਕਾਰਾਂ ਚਾਹੁੰਦੀਆਂ ਹਨ ਉਹੀ ਚੀਜ਼ਾਂ ਨੇ ਜਿਹੜੀਆਂ ਉਹ ਮੀਡੀਆ ਵੱਲੋਂ ਦਿਖਾਈਆਂ ਜਾਂਦੀਆਂ ਹਨ ਜੇ ਆਪਾਂ ਕਿਸਾਨਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਾਂ ਕਹਿ ਲਓ ਪਟਿਆਲੇ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਬਹੁਤ ਇੱਥੇ ਹੜ੍ਹ ਆਏ ਸੀਗੇ ਹੜ੍ਹਾਂ ਦੇ ਦੌਰਾਨ ਕਿਸਾਨਾਂ ਦਾ ਕਿੰਨਾਂ ਕੁ ਨੁਕਸਾਨ ਹੋਇਆ ਠੀਕ ਹੈ ਸਰਕਾਰਾਂ ਨੇ ਕਿਸਾਨਾਂ ਦੇ ਨਾਲ ਵਾਅਦੇ ਕੀ ਕੀਤੇ ਸੀਗੇ ਕਿ ਉਹਨਾਂ ਨੂੰ ਕਿੰਨਾਂ ਕੁ ਮੁਆਵਜ਼ਾ ਦਿੱਤਾ ਜਾਵੇਗਾ ਉਹ ਮੁਆਵਜ਼ਿਆਂ ਦੀਆਂ ਗੱਲਾਂ ਤਾਂ ਮੀਡੀਆ ਨੇ ਲੋਕਾਂ ਤੱਕ ਬਹੁਤ ਖੂਬ ਪਹੁੰਚਾਈਆਂ ਪਰ ਐਕਚੁਅਲ ਦੇ ਵਿੱਚ ਕਿਹਨਾਂ ਕਿਹੜੇ ਕਿਹੜੇ ਕਿਸਾਨਾਂ ਨੂੰ ਕਿੰਨਾਂ ਕਿੰਨਾਂ ਮੁਆਵਜ਼ਾ ਦਿੱਤਾ ਗਿਆ ਹੈ ਜਾਂ ਨਹੀਂ ਦਿੱਤਾ ਗਿਆ ਕਿਸਾਨਾਂ ਦੀ ਅੱਜ ਹਾਲਤ ਕੀ ਹੈ ਜਿਹਨਾਂ ਕਿਸਾਨਾਂ ਨੇ ਹੜ੍ਹਾਂ ਦੀਆਂ ਸਥਿਤੀਆਂ ਦੇਖੀਆਂ ਸੀਗੀਆਂ ਉਹਨਾਂ ਦਾ ਅੱਜ ਦੀ ਸਥਿਤੀ ਕਿੱਦਾਂ ਦੀ ਹੈਗੀ ਹੈ ਕਿਆ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ ਮਿਲਿਆ ਇਹਨਾਂ ਚੀਜ਼ਾਂ ਬਾਰੇ ਚਰਚਾ ਜਿਹੜੀ ਉਹ ਨਹੀਂ ਕੀਤੀ ਗਈ ਹੈਗੀ ਜੋ ਆਪਣੇ ਸਰਕਾਰਾਂ ਚਾਹੁੰਦੀਆਂ ਹਨ ਉਹੀ ਹੈ ਜਿਹੜਾ ਮੀਡੀਆ ਉਹਨਾਂ ਆਪਣੀ ਚੀਜ਼ਾਂ ਨੇ ਜਿਹੜੀਆਂ ਉਹ ਦਿਖਾਉਂਦਾ ਹੈ ਸੋ ਜੇ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਹੱਦ ਤੱਕ ਆ ਜਿਹੜੀ ਉਹ ਸੱਚਾਈ ਦਿਖਾ ਦਿੱਤੀ ਜਾਂਦੀ ਹੈ ਕਿਉਂ ਕਿਉਂਕਿ ਸੋਸ਼ਲ ਮੀਡੀਆ ਕਾਫੀ ਹੱਦ ਤੱਕ ਆਮ ਜਨਤਾ ਦੇ ਹੱਥਾਂ ਦੇ ਵਿੱਚ ਹੈਗਾ